ਜੇਕਰ ਸੈਰ ਸਪਾਟੇ ਦੀ ਗੱਲ ਕੀਤੀ ਜਾਵੇ ਨਾ ਦੇਸ਼ ਵਿੱਚ ਬੜੇ ਤਰ੍ਹਾਂ ਦੇ ਥਾਵਾਂ ਹਨ ਜਿੱਥੇ ਕਿ ਲੋਕ ਬੜੇ ਰੀਝ ਨਾਲ ਜਾਂਦੇ ਹਨ ਜਿਵੇਂ ਕਿ ਹਰਿਦੁਆਰ ਹੋ ਗਿਆ ਵੈਸ਼ਨੋ ਦੇਵੀ ਹੋ ਗਿਆ ਲੋਕ ਗੁਰਦੁਆਰਿਆਂ 'ਚ ਹਰ ਜਗ੍ਹਾ 'ਤੇ ਲੋਕ ਬੜੀ ਰੀਝ ਨਾਲ ਮੱਥਾ ਟੇਕਣ ਜਾਂਦੇ ਹਨ ਇੱਥੇ ਤਾਂ ਦਰਬਾਰ ਸਾਹਿਬ ਵਿੱਚ ਵੀ ਬਹੁਤ ਰੋਜ਼ ਦਾ ਬਹੁਤ ਰਸ਼ ਲੱਗਿਆ ਹੁੰਦਾ ਲੋਕ ਦੂਰੋਂ ਦੂਰੋਂ ਬਾਹਰ ਦੇ ਲੋਕ ਵੀ ਉੱਥੇ ਮੱਥਾ ਟੇਕਣ ਆਉਂਦੇ ਹਨ ਛੁੱਟੀਆਂ ਵਿਚ ਵੀ ਬੱਚੇ ਨੂੰ ਲੋਕ ਆਪਣੇ ਬੱਚਿਆਂ ਨੂੰ ਲੈ ਕੇ ਵੈਸ਼ਨੋ ਮਾਤਾ ਦੇ ਯਾਤਰਾ ਕਰਦੇ ਹਨ ਕੋਈ ਹਰਿਦੁਵਾਰ ਦੀ ਯਾਤਰਾ ਕਰਦਾ ਕੋਈ ਵਰਿੰਦਾਵਨ ਦੀ ਯਾਤਰਾ ਕਰਦਾ ਲੋਕ ਬੜੀ ਦੂਰੋਂ ਦੂਰੋਂ ਚੱਲ ਕੇ ਉਹਨਾਂ ਦੇ ਦਰਸ਼ਨ ਕਰਨ ਜਾਂਦੇ ਹਨ ਜੇ ਯਾਤਰਾ ਦੀ ਗੱਲ ਕਰੀਏ ਯਾਤਰਾ ਲਈ ਤਾਂ ਇੱਥੇ ਬਹੁਤ ਤਰ੍ਹਾਂ ਦੀ ਥਾਵਾਂ ਹਨ ਜਿੱਥੇ ਕਿ ਲੋਕ ਮੱਥਾ ਟੇਕਣ ਲਈ ਜਾਂਦੇ ਹਨ ਹਰ ਤਰ੍ਹਾਂ ਦੇ ਲੋਕ ਬਾਹਰੋਂ ਤੱਕ ਦੇ ਲੋਕ ਇੱਥੇ ਮੱਥਾ ਟੇਕਣ ਲਈ ਆਉਂਦੇ ਹਨ ਸਾਰੀ ਗੁਰਦ ਜੇਕਰ ਗੋਲਡਨ ਟੈਂਪਲ ਦੀ ਗੱਲ ਕੀਤੀ ਜਾਂਦੀ ਤਾਂ ਉੱਥੇ ਲੋਕ ਰਾਤ ਰਾਤ ਰਾਤ ਤੱਕ ਲਾਈਨਾਂ ਵਿੱਚ ਲੱਗ ਕੇ ਉਹਨਾਂ ਦੇ ਦਰਸ਼ਨ ਕਰਨ ਲਈ ਉੱਥੇ ਖੜ੍ਹੇ ਹੁੰਦੇ ਹਨ ਹਰ ਇੱਕ ਤਰ੍ਹਾਂ ਦੀ ਯਾਤਰਾ ਲਈ ਬਹੁਤ ਵਧੀਆ ਸਹੂਲਤ ਕੀਤੀ ਗਈ ਹੈ ਵੈਸ਼ਨੋ ਦੇਵੀ ਯਾਤਰਾ ਵੀ ਬਹੁਤ ਵਧੀਆ ਅੱਜ ਕੱਲ੍ਹ ਤਾਂ ਹਰ ਤਰ੍ਹਾਂ ਦੀ ਸਹੂਲਤ ਚੱਲ ਚੁੱਕੀ ਹੈ ਲੋਕ ਆਪਣੇ ਬੱਚਿਆਂ ਨੂੰ ਲੈ ਕੇ ਹਰ ਛੁੱਟੀਆਂ ਵਿੱਚ ਹਰ ਹਰ ਦੇਸ਼ ਵਿੱਚ ਹਰ ਸ਼ਹਿਰਾਂ ਵਿੱਚ ਕੋਈ ਨਾ ਕੋਈ ਮੰਦਰ ਹੈ ਜਿੱਥੇ ਕਿ ਲੋਕ ਆਪਣੇ ਬੱਚਿਆਂ ਨੂੰ ਮੱਥਾ ਟਿਕਾਉਣ ਲਈ ਲੈ ਕੇ ਜਾਂਦੇ ਹਨ ਲੋਕ ਆਪ ਵੀ ਬੜੀ ਦੂਰ ਦੂਰ ਦੀ ਯਾਤਰਾ ਕਰ ਰਹੇ ਹਨ ਹਰਿਦੁਆਰ ਦੀ ਯਾਤਰਾ ਵੀ ਲੋਕ ਬੜੀ ਵਧੀਆ ਕਰਦੇ ਹਨ ਲੋਕ ਉੱਥੇ ਦੋ ਦੋ ਦਿਨ ਰਹਿ ਕੇ ਉੱਥੇ ਆਪਣਾ ਹਰ ਤਰ੍ਹਾਂ ਦੇ ਦਰਸ਼ਨ ਕਰਕੇ ਉਹਨਾਂ ਦਾ ਮੱਥਾ ਟੇਕ ਕੇ ਲੋਕ ਫਿਰ ਆਪਣੇ ਘਰਾਂ ਨੂੰ ਜਾਂਦੇ ਹਨ ਹੋਰ ਕਈ ਥਾਵਾਂ ਦੀ ਗੱਲ ਕੀਤੀ ਜਾਵੇ ਤਾਂ ਗੁਰਦੁਆਰਿਆਂ ਵਿੱਚ ਵੀ ਬਹੁਤ ਰਸ਼ ਲੱਗਿਆ ਹੁੰਦਾ ਛੁੱਟੀਆਂ ਵਿੱਚ ਤਾਂ ਬਾਹਰ ਬਹੁਤ ਰਸ਼ ਹੁੰਦਾ ਲੋਕ ਹਰ ਤਰ੍ਹਾਂ ਦੀ ਯਾਤਰਾ ਨੂੰ ਕਰਨਾ ਬਹੁਤ ਪਸੰਦ ਕਰਦੇ ਹਨ